ਹਾਂਜੀ ਸਰ ਹਾਂਜੀ ਸਰ ਹਾਂਜੀ ਸਰ ਆਪਣੀ ਫਾਜ਼ਿਲਕਾ ਸਰ ਦਾਡੀ ਸ਼ੋ ਦੇ ਨਾਲ ਇੱਕ ਦੁਕਾਨ ਛੱਡ ਕੇ ਦੂਜੀ ਦੁਕਾਨ ਹੈਗੀ ਹੈ ਸਰ ਅਸ਼ੋਕ ਬੁਕ ਸੈਂਟਰ ਹਾਂਜੀ ਸਰ ਹਾਂਜੀ ਸਰ ਹਾਂਜੀ ਸਰ ਸਾਡੇ ਕੋਲ ਸਾਰੀਆਂ ਪ੍ਰਕਾਰ ਦੀਆਂ ਕਾਪੀਆਂ ਕਿਤਾਬਾਂ ਅਵੇਲੇਬਲ ਹੈਗੀਆਂ ਸਰ ਤੁਹਾਨੂੰ ਕਿਹੜੀਆਂ ਚਾਹੀਦੀਆਂ ਸਰ ਛੋਟੀਆਂ ਕਾਪੀਆਂ ਚਾਹੀਦੀਆਂ ਜਾਂ ਵੱਡੇ ਰਜਿਸਟਰ ਚਾਹੀਦੇ ਆ ਸਰ ਹਾਂਜੀ ਹਾਂਜੀ ਸਾਡੇ ਕੋਲ ਆਪਣੇ ਕੋਲ ਥਰੀ ਨੂੰ ਵਨ ਵੀ ਹੈਗੇ ਆ ਸਰ ਜਿਹੜੇ ਇੱਕ ਕਾਪੀ 'ਚ ਤਿੰਨ ਚਾਰ ਅੰਗਰੇਜ਼ੀ ਪੰਜਾਬੀ ਮੈਥ ਅ ਅਲੱਗ ਅਲੱਗ ਕੰਮ ਕਰਨ ਵਾਸਤੇ ਉਹ ਵੀ ਕਾਪੀਆਂ ਹੈਗੀਆਂ ਸਰ ਬਾਕੀ ਵੱਡੇ ਰਜਿਸਟਰ ਵੀ ਹੈਗੇ ਆ ਰਫ ਰਜਿਸਟਰ ਵੀ ਹੈਗੇ ਆ ਹਾਂਜੀ ਹਾਂਜੀ ਸਰ ਛੋਟੀ ਕਾਪੀ ਜਿਵੇਂ ਆਪਾਂ ਪਿੰਡਾਂ 'ਚ ਜਾਂ ਕਿਸੇ ਹੋਰ ਸਿੰਪਲ ਦੁਕਾਨ ਤੋਂ ਖਰੀਦ ਕੇ ਜੇ ਦਸ ਵਾਲੀ ਕਾਪੀ ਹੈ ਜਾਂ ਵੀਹ ਦੀ ਕਾਪੀ ਹੈ ਵੀਹ ਵਾਲੀ ਕਾਪੀ ਤੁਹਾਨੂੰ ਇੱਥੇ ਪੰਦਰਾਂ ਦੀ ਮਿਲੂਗੀ ਸਰ ਹਾਂਜੀ ਜਿਹੜਾ ਮੰਨ ਲਓ ਦੋ ਸੌ ਦਾ ਬੰਡਲ ਆਉਂਦਾ ਸਰ ਦਸ ਕਾਪੀਆਂ ਦਾ ਉਹ ਤੁਹਾਨੂੰ ਇੱਥੋਂ ਡੇਢ ਸੌ ਦਾ ਮਿਲੂਗਾ ਸਰ

ਰਫ ਕਾਪੀ ਸਰ ਜਿਵੇਂ ਤੁਸੀਂ ਚਾਰ ਸੌ ਰੁਪਏ ਦਾ ਆਪਣੇ ਕੋਲ ਦਸ ਕਾਪੀਆਂ ਦਾ ਸੈੱਟ ਹੈਗਾ ਜੀ ਅਤੇ ਚਾਲੀ ਰੁਪਏ ਦੀ ਇੱਕ ਕਾਪੀ ਪਵੇਗੀ ਤੁਹਾਨੂੰ ਹਾਂਜੀ ਹਾਂਜੀ ਹਾਂਜੀ ਹਾਂਜੀ ਰਫ ਰਜਿਸਟਰ ਵੀ ਹੈਗੇ ਆ ਰਫ ਰਜਿਸਟਰ ਸੌ ਸੌ ਦੇ ਵੀ ਹੈਗੇ ਆ ਪੰਜਾਹ ਦੇ ਵੀ ਹੈਗੇ ਆ ਸਰ ਇੱਕ ਸੌ ਪੈਂਤੀ ਦਾ ਵੀ ਹੈਗਾ ਸਰ ਇੱਕ ਉਹ ਵੱਡਾ ਹੋਵੇਗਾ ਹਾਂਜੀ ਹਾਂਜੀ ਹਾਂਜੀ ਹਾਂਜੀ ਕਵਰ ਵੀ ਹੈਗੇ ਆ ਕਲਰ ਜਿਵੇਂ ਇਹਨਾਂ ਦੇ ਪ੍ਰਿੰਟਡ ਵੀ ਹੈਗੇ ਆ ਅਤੇ ਸਿੰਪਲ ਕਵਰ ਵੀ ਹੈਗੇ ਆ ਸਾਰੇ ਕਵਰ ਹੈਗੇ ਆ ਕਵਰ ਸਰ ਉਹ ਦੇਖੋ ਤੁਸੀਂ ਵੀ ਪੰਜ ਰੁਪਏ ਤੋਂ ਸ਼ੁਰੂ ਹੁੰਦੇ ਆ ਸਾਡੇ ਕੋਲ ਕਵਰ ਅਤੇ ਪੰਜਾਹ ਰੁਪਏ ਤੱਕ ਦੇ ਕਵਰ ਹੈਗੇ ਆ ਸਾਡੇ ਕੋਲ ਉਹ ਹੁਣ ਤੁਸੀਂ ਸਿਲੇਕਟ ਕਰਨਾ ਵੀ ਕਿਹੜਾ ਕਵਰ ਲੈਣਾ ਸਰ ਪੰਜ ਦਾ ਵੀ ਹੈ ਪੰਦਰਾਂ ਦਾ ਵੀ ਹੈ ਵੀਹ ਦਾ ਵੀ ਹੈ ਪੈਂਤੀ ਦਾ ਵੀ ਹੈ ਚਾਲੀ ਦਾ ਵੀ ਹੈ ਪੰਜਾਹ ਦਾ ਵੀ ਹੈ ਉਹ ਤੁਸੀਂ ਆਪਣੇ ਹਿਸਾਬ ਨਾਲ ਵੇਖੋ ਵੀ ਕਿਹੜਾ ਤੁਸੀਂ ਲੈਣਾ ਹਾਂਜੀ ਹਾਂਜੀ ਹਾਂਜੀ ਸਰ ਬੁਕਸ ਵੀ ਅਵੇਲੇਵਲ ਬਾਕੀ ਤੁਸੀਂ ਦੁਕਾਨ 'ਤੇ ਆਓ ਸਰ ਆ ਕੇ ਸਾਡੀ ਦੁਕਾਨ 'ਤੇ ਵਿਜਿਟ ਕਰੋ ਹਾਂਜੀ ਹਾਂਜੀ ਅਤੇ ਪ੍ਰਾਈਜ਼ ਸਰ ਉਹ ਉਹ ਜਿਹੜੀ ਮਤਲਬ ਬੁਕਸ ਤੁਸੀਂ ਲਉਗੇ ਨਾ ਉਸ 'ਤੇ ਅਸੀਂ ਦੇਖਾਂਗੇ ਵੀ ਕਿਹੜੀ ਕਿਤਾਬ ਤੁਸੀਂ ਲੈਣੀ ਆ ਉਸ ਹਿਸਾਬ ਨਾਲ ਤੁਹਾਨੂੰ ਪ੍ਰਾਈਜ ਲੱਗਣਗੇ ਤੁਹਾਨੂੰ ਪੰਦਰਾਂ ਪੰਦਰਾਂ ਵੀਹ ਪ੍ਰਸੈਂਟ ਲੈਸ ਵੀ ਹੋਜੂਗਾ ਹਾਂਜੀ ਹਾਂਜੀ ਜਿਹੜੀ ਸੌ ਵਾਲੀ ਕਿਤਾਬ ਉਹ ਤੁਹਾਨੂੰ ਲੈਸ ਕਰਕੇ ਅੱਸੀ ਰੁਪਇਆ ਦੀ ਦਿਆਂਗਾ

ਹਾਂਜੀ ਹਾਂਜੀ ਸਾਡੇ ਕੋਲ ਸਾਰਾ ਹੀ ਅਵੇਲੇਵਲ ਹੈਗਾ ਤੁਸੀਂ ਸਾਡੀ ਦੁਕਾਨ 'ਤੇ ਵਿਜਿਟ ਕਰੋ ਸਰ ਹਾਂਜੀ ਹਾਂਜੀ ਸਾਰਾ ਕੁਝ ਹੀ ਆਪਣੇ ਕੋਲ ਹਾਂਜੀ ਹਾਂਜੀ ਸਾਰਾ ਕੁਝ ਸਾਰਾ ਕੁਝ ਹਾਂਜੀ ਹਾਂਜੀ ਠੀਕ ਹੈ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ